ਨਹੀਂ ਮੈਂ ਕਿਸੇ ਪ੍ਰਕਾਰ ਦੀ ਗੇਮ ਬੋਕਸ ਅਤੇ ਵਰਚੁਅਲ ਰਿਐਲਟੀ ਗੇਮਸ ਨਹੀਂ ਖੇਡਦੀ ਹਾਂ ਕਿਉਂਕਿ ਮੈਨੂੰ ਇਹਨਾਂ ਵਿੱਚ ਕੋਈ ਵੀ ਇਹਨਾਂ ਵਿੱਚ ਕੋਈ ਕਿਸੇ ਵੀ ਪ੍ਰਕਾਰ ਦੀ ਮੇਰੀ ਰੁਚੀ ਨਹੀਂ ਹੈ ਮੈਂ ਗਰਾਊਂਡ ਵਿੱਚ ਹੀ ਆਪਣੀ ਪ੍ਰੈਕਟਿਸ ਕਰਨਾ ਪਸੰਦ ਕਰਦੀ ਹਾਂ ਇਸ ਲਈ ਮੈਂ ਇਸ ਨਾਲ ਸੰਬੰਧਿਤ ਕੋਈ ਵੀ ਆਪਣਾ ਅਨੁਭਵ ਤੁਹਾਨੂੰ ਪੇਸ਼ ਨਹੀਂ ਕਰ ਸਕਦੀ